ਸਾਡੇ ਪੰਜਾਬੀ ਲੋਕ ਹਮੇਸ਼ਾ ਆਪਣੇ ਘਰਾਂ ਵਿੱਚ ਮੁਹਾਵਰਿਆਂ ਦੀ ਵਰਤੋਂ ਹੀ ਕਰਦੇ ਹਨ ਮੁਹਾਵਰਿਆਂ ਵਿੱਚ ਇਕੱਲਾ ਇੱਕ ਦੂਜੇ ਨੂੰ ਗੱਲਾਂ ਬਾਤਾਂ ਕਰਦੇ ਹਨ ਜਿਵੇਂ ਅੱਖ ਦਾ ਤਾਰਾ ਆਪਣਾ ਉੱਲੂ ਸਿੱਧਾ ਕਰਨਾ ਗੱਲ ਨਾ ਸੁਣਨਾ ਇਹ ਇਹ ਮੁਹਾਵਰਿਆਂ ਵਿੱਚ ਹੀ ਗੱਲਾਂ ਕਰਦੇ ਹਨ ਪੰਜਾਬੀ ਹਮੇਸ਼ਾ ਮੁਹਾਵਰੇ ਮੁਹਾਵਰਾ ਹੀ ਯੂਜ ਵਰਤਦੇ ਹਨ